ਮੇਨ ਖੇਡ ਸਾਡੀ ਪੰਜਾ ਦੇ 'ਚ ਖੋ ਖੋ ਦਾ ਮੇਰਾ ਬਹੁਤ ਇੰਟਰਸਟ ਹੈ ਜੀ ਖੋ ਖੋ 'ਚ ਜਿਵੇਂ ਬੱਚਾ ਇ ਇੱਕ ਟੀਮ ਭੱਜ ਰਹੀ ਹੁੰਦੀ ਆ ਅਤੇ ਇੱਕ ਬੈਠੀ ਹੁੰਦੀ ਆ ਜੇ ਤੁਸੀਂ ਵਿ ਵਿੱਚੋਂ ਖੋ ਖੋ ਕਰ ਰਹੇ ਥੱਲੇ ਬੈਠੇ ਨੂੰ ਖੋ ਖੋ ਕਰਕੇ ਅਤੇ ਉਹ ਪੂਰਾ ਰਾਊਂਡ ਲਾ ਕੇ ਤਾਂ ਵਾਪਸ ਆ ਸਕਦਾ ਇੱਧਰ ਵਿੱਚੋਂ ਵਾਪਸ ਨਹੀਂ ਮੁੜ ਸਕਦਾ ਜਿਹੜਾ ਪਲੇਅਰ ਆ ਉਹ ਬੈਠੇ ਹੋਇਆਂ ਦੇ ਵਿੱਚੋਂ ਵੀ ਇੱਧਰ ਖੱਬੇ ਸੱਜੇ ਹੋ ਸਕਦਾ ਹੈ ਅਤੇ ਜਿਹੜਾ ਇੱਕ ਵਾਰ ਬੱਚਾ ਆਊਟ ਹੋ ਗਿਆ ਉਹ ਦੁਬਾਰਾ ਅਗਲੇ ਮੈਚ 'ਚ ਖੇਲੂਗਾ ਉਸ ਮੈਚ 'ਚ ਉਹਨੂੰ ਆਊਟ ਹੋ ਜਾਂਦਾ ਹੈ